ਸਾਡੀ ਰਸੋਈ ਵਿੱਚ ਬਹੁਤ ਸਾਰੇ ਉਪਕਰਨ ਆ ਗਏ ਹਨ ਜਿੱਦਾਂ ਕੀ ਮਾਈਕ੍ਰੋਵੇਵ ਅਵਨ ਆ ਗਿਆ ਹੈ ਮਿਕਸੀ ਗਰੈਂਡਰ ਆ ਗਿਆ ਹੈ ਰੈਫਰੀਜੀਰੇਟਰ ਆ ਗਏ ਨੇ ਤੇ ਜਿਸ ਕਰਕੇ ਕਿ ਬਹੁਤ ਕੰਮ ਸੌਖਾ ਹੋ ਗਿਆ ਪਹਿਲੇ ਜਮਾਨੇ ਚ ਜਿੱਦਾਂ ਕੀ ਚੂਲਾ ਹੁੰਦਾ ਸੀ ਤੇ ਕੁੰਡੀ ਸੋਟਾ ਹੁੰਦਾ ਸੀ ਜਿਹਦੇ ਨਾਲ ਅਸੀਂ ਮਸਾਲੇ ਕੁੱਟਦੇ ਸੀ ਜਿਹਦੇ ਵਿੱਚ ਮੈਂ ਆਪਣੀ ਮਾਤਾ ਜੀ ਨੂੰ ਦੇਖਿਆ ਤੇ ਬਾਕੀ ਪਿੰਡ ਵਾਲਿਆਂ ਨੇ ਦੇਖਿਆ ਕਈ ਪਿੰਡ ਵਾਲਿਆਂ ਨੂੰ ਹਲੇ ਵੀ ਪਿੰਡਾਂ ਚ ਇਦਾਂ ਕੁਝ ਹੈ ਪਰ ਹੁਣ ਕਾਫੀ ਸੁਧਾਰ ਹੋ ਗਿਆ ਕਾਫੀ ਚੀਜ਼ਾਂ ਆ ਗਈਆਂ ਜਿਹਦੇ ਨਾਲ ਸਾਡਾ ਟਾਈਮ ਦੀ ਬਚਤ ਹੋਈ ਤੇ ਮੇਰੇ ਮਾਤਾ ਜੀ ਪਹਿਲਾਂ ਚੂਲੇ ਤੇ ਰੋਟੀ ਬਣਾਉਂਦੇ ਸੀ ਤੇ ਫਿਰ ਬਾਅਦ ਚ ਕੁੰਡੀ ਸੋਟੇ ਨਾਲ ਮਸਾਲਾ ਕੁੱਟਦੇ ਸੀ ਕੀ ਉਹ ਬਹੁਤ ਥੱਕ ਜਾਂਦੇ ਸੀ ਤੇ ਸਾਰਾ ਟਾਈਮ ਉਹਚੇ ਹੀ ਨਿਕਲ ਜਾਂਦਾ ਸੀ ਅੱਜਕੱਲ ਕੰਮ ਬਹੁਤ ਹੀ ਜਿਆਦਾ ਸੌਖਾ ਹੋ ਗਿਆ ਤੇ ਸਾਨੂੰ ਇਸ ਚੀਜ਼ ਦਾ ਬਹੁਤ ਹੀ ਲਾਭ ਹੋਇਆ ਸਿਲਿੰਡਰ ਆ ਗਏ ਨੇ ਉਹਦੀ ਥਾਂ ਤੇ ਮਿਕਸੀ ਆ ਗਈ ਹ ਤੇ ਰੈਫਰੀਜੀਰੇਟਰ ਆ ਗਏ ਨੇ ਜਿਹਦੇ ਨਾਲ ਕੀ ਚੀਜ਼ਾਂ ਖਰਾਬ ਨਹੀਂ ਹੁੰਦੀਆਂ ਤੇ ਇਸ ਕਰਕੇ ਸਾਨੂੰ ਫਾਇਦਾ ਹੋਇਆ ਤੇ ਸਮਾਜ ਬਹੁਤ ਅੱਗੇ ਵੀ ਵੱਧ ਰਿਹਾ ਇਸ ਕਰਕੇ ਮੈਂ ਬਹੁਤ ਖੁਸ਼ ਹਾਂ ਕੀ ਮੇਰੇ ਮਾਤਾ ਜੀ ਵੀ ਹੁਣ ਮੈਂ ਬਹੁਤ ਸਾਰੀਆਂ ਚੀਜ਼ਾਂ ਮਿਲ ਚੁੱਕੀਆਂ ਨੇ ਜਿਹਦੇ ਨਾਲ ਕਿ ਸਾਡੀ ਟਾਈਮ ਦੀ ਬਚਤ ਹੁੰਦੀ ਹ ਅਸੀਂ ਕੋਈ ਬਾਹਰ ਵੀ ਕੰਮ ਕਰਨੇ ਜਾ ਸਕਦੇ ਆਂ ਅੱਜਕੱਲ ਜਨਾਨੀ ਬਾਹਰ ਵੀ ਕੰਮ ਕਰ ਲੈਂਦੀਆਂ ਨੇ ਤੇ ਬਹੁਤ ਹੀ ਮਤਲਬ ਅਪ ਟੂ ਡੇਟ ਹੋ ਚੁੱਕਾ ਸਾਡਾ ਸਮਾਜ ਕਿਉਂਕਿ ਬਹੁਤ ਕਾਬਲੇ ਤਾਰੀਫ ਹੈ ਧੰਨਵਾਦ